ਸਟਾਰਗੇਜ਼ਿੰਗ ਜਿਵੇਂ ਕਿ ਆਪਾਂ ਲਗਾ ਲਈਏ ਕੀ ਤਾਰਿਆਂ ਨੂੰ ਦੇਖਣਾ ਬਚਪਨ ਤੋਂ ਹੀ ਸ਼ੌਂਕ ਹੁੰਦਾ ਇਹ ਸਟਾਰਗੇਜਿੰਗ ਮੇਰਾ ਸ਼ੁਰੂ ਤੋਂ ਹੀ ਸ਼ੌਂਕ ਹੁੰਦਾ ਸੀ ਬਟ ਜਦੋਂ ਵੱਡੇ ਹੋਏ ਤਾਂ ਮੇਰੀ ਇੱਕ ਪਸੰਦੀਦਾ ਜੋ ਮੈਮਰੀ ਆ ਉਹ ਇਹ ਯੂਨੀਵਰਸਿਟੀ ਟਾਈਮ ਦੀ ਜਦੋਂ ਅਸੀਂ ਸਾਰੇ ਇਕੱਠੇ ਬੈਠ ਕੇ ਸਟਾਰਸ ਨੂੰ ਦੇਖਦੇ ਹੁੰਦੇ ਸੀਗੇ ਫਰੈਂਡਸ ਦੇ ਵਿੱਚ ਬੈਠ ਕੇ ਅਸੀਂ ਸਟਾਰਜ਼ ਨੂੰ ਦੇਖਦੇ ਹੁੰਦੇ ਸੀ ਅਤੇ ਜੇ ਮੈਂ ਗੱਲ ਕਰਾਂ ਤਾਂ ਸਟਾਰਜ਼ ਤਾਂ ਇਹ ਬਚਪਨ ਤੋਂ ਹੀ ਦੇਖਣੇ ਸ਼ੁਰੂ ਕੀਤੇ ਸੀਗੇ ਅਤੇ ਜੇ ਆਪਾਂ ਲਗਾਈਏ ਕੀ ਆਕਾਸ਼ ਨੂੰ ਵੇਖਣ ਦਾ ਸਹੀ ਸਮਾਂ ਤਾਂ ਆਪਾਂ ਕਹਿ ਸਕਦੇ ਆ ਕਿ ਜਿਵੇਂ ਕਿ ਨੌ ਜਾਂ ਦਸ ਵਜੇ ਦੇ ਵਿੱਚ ਸਟਾਰਜ਼ ਜਿਵੇਂ ਸਰਦੀ ਗਰਮੀਆਂ ਦੇ ਵਿੱਚ ਜਿਹੜੇ ਇਹ ਦੇਖਣੇ ਸ਼ੁਰੂ ਹੋ ਜਾਂਦੇ ਹਨ